ਹੈਲੋ ਹਾਂਜੀ ਮੈਮ ਹਾਂਜੀ ਮੈਮ ਲੱਸੀ ਲੈਣੀ ਸੀ ਦੱਸਿਓ ਲੱਸੀ ਦੇ ਫਲੇਵਰ ਹੈਗੇ ਅਲੱਗ ਅਲੱਗ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਇਹ ਇਹ ਮੈਡਮ ਪਿਓਰ ਦੁੱਧ ਦੀ ਬਣਾਉਂਦੇ ਹੋ ਤੁਸੀਂ ਹਾਂਜੀ ਠੀਕ ਹੈ ਅਤੇ ਇਹਨਾਂ ਦੇ ਤੁਸੀਂ ਰੇਟ ਦੱਸ ਸਕਦੇ ਹਾਂਜੀ ਬੋਲੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮੈਮ ਹਾਂ ਦੱਸੋਗੇ ਤੁਸੀਂ ਇਹਨਾਂ ਦਾ ਕੋਈ ਰੇਟ ਵਗੈਰਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇਹ ਪੁਦੀਨੇ ਵਾਲੀ ਲੱਸੀ 'ਚ ਮੈਡਮ ਤੁਸੀਂ ਕੀ ਕੀ ਮਿਕਸ ਕਰਦੇ ਠੀਕ ਹੈ ਠੀਕ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਮੈਮ ਠੀਕ ਹੈ ਮੈਮ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ